ਸਟੀ ਸ਼੍ਰੀ ਅਕਾਲ ਮੈਮ ਮੇਰਾ ਮੇਰਾ ਬਿਜ਼ਨਸ ਲੋਸਟ ਚੱਲ ਰਿਹਾ ਹੈਗਾ ਤੁਸੀਂ ਮੇਰਾ ਬਿਜਨਸ ਅਪ ਕਰਨ 'ਚ ਕੀ ਹੈਲਪ ਕਰ ਸਕਦੇ ਹੋ

ਹਾਂਜੀ ਹੈਲਪ

ਹਾਂਜੀ ਹਾਂਜੀ ਹਾਂਜੀ ਹਾਂਜੀ ਵਰਕਰ ਸਹੀ ਤਰ੍ਹਾਂ ਕੰਮ ਨਹੀਂ ਕਰਦੇ ਨਹੀਂ ਸਹੀ ਤਰ੍ਹਾਂ ਨਾਲ ਨਹੀਂ ਕੰਮ ਕਰਦੇ

ਹਾਂਜੀ ਹੈਲਪ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇਸ ਇਸ ਨਾਲ ਮੇਰਾ ਬਿਜ਼ਨਸ ਵਧੀਆ ਹੋ ਜਾਊ ਨਾ ਮੈਨੂੰ ਲੱਗਦਾ ਕਿ ਹੋ ਜਾਊਗਾ ਠੀਕ ਹੈ ਮੈਡਮ ਧੰਨਵਾਦ ਮੈਂ ਤੁਹਾਨੂੰ ਬਾਅਦ 'ਚ ਕੋਂਟੈਕਟ ਕਰੂੰਗਾ ਜੇ ਕੋਈ ਹੱਲ ਨਾ ਹੋਇਆ